ਮੇਰੇ ਕੋਲ ਵਿਸ਼ੇਸ਼ ਹੁਨ ਹੁਨਰ ਦੇ ਵਿੱਚ ਪੰਜਾਬੀ ਟਾਈਪਿੰਗ ਹੈ ਮੈਂ ਪੰਜਾਬੀ ਟਾਈਪਿੰਗ ਜਿਹੜੀ ਹੈਗੀ ਹੈ ਬਹੁਤ ਵਧੀਆ ਤਰੀਕੇ ਨਾਲ ਕਰਦਾਂ ਅਤੇ ਕਾਫੀ ਮੇਰੀ ਇਹਦੇ ਵਿੱਚ ਕਾਫੀ ਸਪੀਡ ਹੈ ਅਤੇ ਜਿਹੜਾ ਇਹ ਹੁਨਰ ਹੈਗਾ ਮੈਨੂੰ ਹੌਲੀ ਹੌਲੀ ਮੇਰੇ ਕੋਲ ਹੌਲੀ ਹੌਲੀ ਵਿਕਸਿਤ ਕੀਤਾ ਗਿਆ ਮੈਂ ਕਾਫੀ ਸਾਲ ਤੋਂ ਉਹਦੀ ਪ੍ਰੈਕਟਿਸ ਕੀਤੀ ਹੈ ਅਤੇ ਜਿਸ ਨਾਲ ਮੇਰੀ ਜਿਹੜੀ ਸਪੀਡ ਹੈਗੀ ਹੈ ਉਹ ਤੀਹ ਵਰਡ ਪਰ ਸੈ ਪਰ ਮਿੰਟ ਹੈਗੀ ਹੈ ਇਸ ਨਾਲ ਮੈਂ ਕਾਫੀ ਜ਼ਿਆਦਾ ਮੈਨੂੰ ਜੋ ਹੈ ਫਾਇਦਾ ਹੁੰਦਾ ਹੈ ਅਤੇ ਮੈਂ ਇਸ ਤੋਂ ਵੀ ਜ਼ਿਆਦਾ ਜਿਹੜੇ ਆਪਣੇ ਕੰਮ ਨੂੰ ਹੈਗਾ ਚੰਗੀ ਸਪੀਡ ਨਾਲ ਨਿਪਟਾਇਆ ਨਿਪਟਾਉਂਦਾ ਹਾਂ ਅਤੇ ਮੈਨੂੰ ਟਾਈਪਿੰਗ ਕਰਨਾ ਮੇਰਾ ਸ਼ੌਂਕ ਹੈ ਅਤੇ ਮੈਨੂੰ ਬਹੁਤ ਅੱਛਾ ਲੱਗਦਾ ਹੈ